ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਮਲਜੀਤ ਕੌਰ ਹੈ ਅਤੇ ਮੈਂ ਲਾਲ ਕਿਲ੍ਹਾ ਦੇ ਨੇੜੇ ਗਲੀ ਨੰਬਰ ਪੰਜ ਸਤਵੰਜਾ ਨੰਬਰ ਹਾਊਸ ਤੋਂ ਬੋਲ ਰਹੀ ਹਾਂ ਮੈਂ ਹੁਣੇ ਹੁਣੇ ਥੋੜੀ ਦੇਰ ਪਹਿਲਾਂ ਤੁਹਾਡੀ ਇੱਕ ਕੈਬ ਬੁੱਕ ਕੀਤੀ ਹੈ ਮੈਂ ਇੰਡੀ ਇੰਦਰਾ ਗਾਂਧੀ ਨੈਸ਼ਨਲ ਏਅਰਪੋਰਟ 'ਤੇ ਕੱਲ੍ਹ ਤਿੰਨ ਵਜੇ ਪਹੁੰਚਣਾ ਅਤੇ ਪੰਜ ਵਜੇ ਮੇਰੀ ਫਲਾਈਟ ਆ ਅਤੇ ਇਸ ਲਈ ਮੈਂ ਇਹ ਜਾਨਣਾ ਚਾਹੁੰਦੀ ਹਾਂ ਕਿ ਮੈਂ ਉਸ ਉੱਥੇ ਟਾਈਮ ਨਾਲ ਪਹੁੰਚ ਜੂੰਗੀ ਕਿ ਕਿੱਦਾਂ ਹੋਵੇਗਾ ਕਿ ਮੈਂ ਤਿੰਨ ਵਜੇ ਉੱਥੇ ਪਹੁੰਚਣਾ ਅਤੇ ਤੁਸੀਂ ਮੈਨੂੰ ਕਿੰਨੇ ਵਜੇ ਇੱਥੋਂ ਲੈਣ ਆਉਂਗੇ ਮੈਂ ਇਹ ਸਭ ਬਾਰੇ ਜਾਣਕਾਰੀ ਲੈਣਾ ਚਾਹੁੰਦੀ ਹਾਂ ਕਿ ਮੈਂ ਉੱਥੇ ਜਾਂਦੀ ਲੇਟ ਨਾ ਹੋ ਜਾਂ ਕਿਉਂਕਿ ਪੰਜ ਵਜੇ ਮੇਰੀ ਫਲਾਈਟ ਆ ਅਤੇ ਮੈਂ ਰਸਤੇ 'ਚ ਵੀ ਕੁਛ ਸਮਾਨ ਖਰੀਦਣਾ ਅਤੇ ਇਸ ਲਈ ਮੈਨੂੰ ਇਹ ਦੱਸਿਆ ਜਾਵੇ ਕਿ ਮੈਂ ਉੱਥੇ ਕਿੰਨੇ ਵਜੇ ਪਹੁੰਚ ਜਾਵਾਂਗੀ ਅਤੇ ਰਸਤੇ ਵਿੱਚ ਕਿੰਨੀ ਦੇਰ ਲੱਗੇਗੀ ਅਤੇ ਉੱਥੇ ਮਤਲਬ ਤੁਸ ਤੁਸੀਂ ਮੈਨੂੰ ਲੈਣ ਕਿੰਨੇ ਵਜੇ ਆ ਜਾਓਗੇ ਇਸ ਸਬੰਧੀ ਮੈਨੂੰ ਕੁਛ ਜਾਣਕਾਰੀ ਚਾਹੀਦੀ ਹੈ